ਸਰ ਮੇਰਾ ਨਾਂ ਭਾਰਤ ਭੂਸ਼ਨ ਹੈ ਮੈਂ ਪਿੰਡ ਮਾਧੋਪੁਰ ਦਾ ਰਹਿਣ ਵਾਲਾ ਜ਼ਿਲ੍ਹਾ ਪਠਾਨਕੋਟ ਅਤੇ ਮੇਰਾ ਤਾਂ ਬਚਪਨ 'ਚ ਬਹੁਤ ਜ਼ਿਆਦਾ ਸੌਂਕ ਸੀ ਪਰ ਸਵੀਮਿੰਗ ਮੇਰਾ ਬੈਸਟ ਸਾਰਿਆਂ ਤੋਂ ਵਧੀਆ ਸੌਂਕ ਰਿਹਾ ਅਤੇ ਬਚਪਨ ਤੋਂ ਹੀ ਅਸੀਂ ਆਪਣੇ ਇਲਾਕੇ ਵਿੱਚ ਨਹਿਰਾਂ ਵਿੱਚ ਨਹਾਉਂਦੇ ਆਏ ਹਾਂ ਸਾਡੇ ਪਿੰਡ ਦੇ ਲਾਗੇ ਇੱਕ ਬਿਆਸ ਲਿੰਕ ਨਹਿਰ ਅਤੇ ਦੂਸਰਾ ਰਾਵੀ ਰਿਵਰ ਵਗਦਾ ਹੈ ਅਤੇ ਆਪਾਂ ਬਚਪਨ ਤੋਂ ਹੀ ਇਹਨਾਂ ਵਿੱਚ ਨਹਾਉਂਦੇ ਆਏ ਹਾਂ ਪਹਿਲਾਂ ਪਹਿਲਾਂ ਤਾਂ ਥੋੜ੍ਹਾ ਡਰ ਲੱਗਦਾ ਸੀ ਨਹਾਉਂਣ ਤੋਂ ਫਿਰ ਬਾਅਦ ਦੇ ਵਿੱਚ ਹੌਲੀ ਹੌਲੀ ਅਭਿਆਸ ਹੋ ਗਿਆ ਪਹਿਲਾਂ ਆਪਾਂ ਖਲੋਤੇ ਪਾਣੀ ਵਿੱਚ ਸਵੀਮਿੰਗ ਸਿੱਖੀ ਫਿਰ ਹੌਲੀ ਹੌਲੀ ਵਗਦੇ ਪਾਣੀ ਵਿੱਚ ਅਤੇ ਐਕਸਪੀਰੀਅੰਸ ਹੁੰਦਾ ਹੁੰਦਾ ਹੋ ਗਿਆ ਅਤੇ ਅਸੀਂ ਨਹਿਰ ਨੂੰ ਆਰ ਪਾਰ ਕਰਨਾ ਸ਼ੁਰੂ ਕਰ ਦਿੱਤਾ ਫਿਰ ਜਦੋਂ ਅਸੀਂ ਵੱਡੇ ਹੋ ਗਏ ਸਕੂਲ ਚੱਲ ਗਏ ਸਕੂਲ ਦੇ ਵਿੱਚ ਆਪਣੀ ਸਪੋਰਟਸ ਰਖਾ ਲਿਆ ਸਪੋਰਟ ਦੇ ਵਿੱਚ ਸਾਡੀ ਟ੍ਰੇਨਿੰਗ ਪਠਾਨਕੋਟ ਜ਼ਿਲ੍ਹੇ ਦੇ ਐਸ ਡੀ ਗਰਾਊਂਡ ਦੇ ਲਾਗੇ ਪੈਂਦੇ ਸਵੀਮਿੰਗ ਪੂਲ ਦੇ ਵਿੱਚ ਰਖਵਾਈ ਗਈ ਉੱਥੇ ਅਸੀਂ ਬੈਕ ਸਟੋਕ ਅਤੇ ਬਟਰਫਲਾਈ ਅਤੇ ਸੌ ਮੀਟਰ ਅ ਰੇਲੇ ਚਾਰ ਸੌ ਮੀਟਰ ਰੇਲੇ ਅਤੇ ਕਾਫ਼ੀ ਜ਼ਿਆਦਾ ਨੋਲੇਜ ਪ੍ਰਾਪਤ ਕੀਤੀ ਸਵਿਮਿੰਗ ਬਾਰੇ ਉਸ ਤੋਂ ਬਾਅਦ ਸਾਡਾ ਕੰਪੀਟੇਕਸ ਕੰਪਟੀਸ਼ਨ ਜ਼ਿਲ੍ਹਾ ਲੈਵਲ ਦਾ ਜਲੰਧਰ ਸਪੋਰਟਸ ਕੋਲਜ ਵਿੱਚ ਹੋਇਆ ਉੱਥੇ ਅਸੀਂ ਜਾ ਕੇ ਸਵਿਮਿੰਗ ਕੀਤੀ ਸਾਡਾ ਸਥਾਨ ਦੂਜਾ ਨੰਬਰ ਰਿਹਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸਾਡਾ ਇਸ ਦੌਰਾਨ ਦੇ ਵਿੱਚ ਸਾਡੀ ਟੀਮ ਨੂੰ ਸੈਕਿੰਡ ਅਵਾਰਡ ਵੀ ਮਿਲਿਆ ਅਤੇ ਮੈਂ ਚਾਹੁੰਦਾ ਕਿ ਹਰ ਕੋਈ ਸਵਿਮਿੰਗ ਸਿੱਖੇ ਧੰਨਵਾਦ